ਖੇਡਾਂ ਹੱਸਣਾ ਖੇਡਣਾ ਮਨ ਦਾ ਚਾਓ ਲਿਖਿਆ ਵਿੱਚ ਗੁਰਬਾਣੀ ਕਿਉਂਕਿ ਖੇਡਾਂ ਸਾਡੇ ਸਰੀਰ ਨੂੰ ਸਾਡੇ ਸਮਾਜ ਨੂੰ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੀਆਂ ਸਮਾਜ ਦੇ ਵਿੱਚ ਖੇਡਾਂ ਖੇਡਣ ਦਾ ਮਹੱਤਵ ਜਾਂ ਪੇਂਡੂ ਲੋਕਾਂ ਦੀ ਰਾਇ ਆਪਾਂ ਕਹੀਏ ਬਹੁਤ ਚੰਗੀ ਹੈ ਹਰ ਜਿਹੜਾ ਸਮਾਜ ਹੈ ਉਹ ਖੇਡਾਂ ਨੂੰ ਉਤਸ਼ਾਹਿਤ ਕਰਦਾ ਹੈ ਜਿਸਦੇ ਨਾਲ ਆਮ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਖੇਡ ਗਰਾਊਂਡ ਬਣਿਆ ਪੰਚਾਇਤੀ ਜ਼ਮੀਨਾਂ ਆ ਉਹਨਾਂ ਵਿੱਚ ਜਿਹੜੇ ਗਰਾਊਂਡ ਛੱਡੇ ਹੋਏ ਆ ਤਾਂ ਕਿ ਜਿਹੜੇ ਪਿੰਡ ਦੇ ਨੌਜਵਾਨ ਬੱਚੇ ਉਹ ਖੇਡਣ ਉਹ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਪੇਂਡੂ ਲੋਕ ਖੇਡਾਂ ਨੂੰ ਬਹੁਤ ਮਹੱਤਵ ਦਿੰਦੇ ਆ ਸਮੇਂ ਸਮੇਂ 'ਤੇ ਟੂਰਨਾਮੈਂਟ ਵੀ ਕਰਵਾਉਂਦੇ ਹੈ ਸਾਡੇ ਪਿੰਡ ਵੀ ਟੂਰਨਾਮੈਂਟ ਹੁੰਦਾ ਹੈ ਇਹ ਟੂਰਨਾਮੈਂਟਾਂ 'ਤੇ ਇਨਾਮ ਰੱਖੇ ਜਾਂਦੇ ਹੈ ਜਿਹੜੇ ਲੋਕ ਹੈ ਉਹ ਦੂਰੋਂ ਦੂਰੋਂ ਦੇਖਣ ਆਉਂਦੇ ਆ ਖਿਡਾਰੀ ਵੀ ਖੇਡਣ ਆਉਂਦੇ ਹੈ ਇਹ ਸਮਾਜ ਨੂੰ ਚੰਗੀ ਦਿਸ਼ਾ ਵੱਲ ਭੇਜਦੇ ਹੈ ਸਮਾਜ 'ਚ ਖੇਡਾਂ ਦੀ ਜਿਹੜੀ ਮਹੱਤਤਾ ਹੈ ਉਹ ਬਹੁਤ ਜ਼ਿਆਦੇ ਆ ਕਿਉਂਕਿ ਖੇਡਾਂ ਦੇ ਬੇਸ 'ਤੇ ਨੌਕਰੀਆਂ ਵੀ ਮਿਲਦੀਆਂ ਹੈ ਹੁਣ ਜੇਕਰ ਆਪਾਂ ਗੱਲ ਕਰੀਏ ਪਿੰਡਾਂ ਦੀ ਤਾਂ ਪੇਂਡੂ ਜਿਹੜੇ ਲੋਕ ਹੈ ਉਹ ਆਪਣੇ ਬੱਚਿਆਂ ਨੂੰ ਤੀਰ ਅੰਦਾਜ਼ੀ ਹਾਕੀ ਜਮਨਾਸ਼ਟਿਕ ਅਜਿਹੀਆਂ ਖੇਡਾਂ 'ਚ ਵੀ ਹੁਣ ਪਾਉਣ ਲੱਗ ਗਏ ਕਿਉਂਕਿ ਖੇਡਾਂ ਜਿਹੜੀਆਂ ਸਰਕਾਰ ਨੇ ਗੇਮਾਂ ਦੇ ਵਿੱਚ ਅਲਾਓ ਕੀਤੀਆਂ ਕਿ ਗੇਮਾਂ ਜਿਹੜੇ ਬੱਚੇ ਕੋਲ ਹੋਣਗੀਆਂ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਇਹਦੇ ਨਾਲ ਖੇਡਾਂ ਨੂੰ ਪੇਂਡੂ ਲੋਕਾਂ ਵਿੱਚ ਹੋਰ ਵੀ ਉਤਸ਼ਾਹਿਤਾਂ ਮਿਲੀ ਹੈ ਉਹ ਆਪਣੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਭੇਜ ਕੇ ਨਸ਼ਿਆਂ ਤੋਂ ਦੂਰ ਰੱਖਦੇ ਹੈ ਨਾਲ ਦੀ ਨਾਲ ਹੀ ਜਿਹੜੀ ਨੌਕਰੀ ਹੈ ਬਈ ਉਹ ਬੱਚੇ ਨੂੰ ਸਾਡੇ ਨੌਕਰੀ ਮਿਲੇ ਉਹ ਬੱਚਾ ਸੌਖਾ ਹੋਵੇ ਉਸ ਦਾ ਸਰੀਰ ਤੰਦਰੁਸਤ ਰਹੇ ਹੁਣ ਖੇਡਾਂ ਵਿੱਚ ਭੇਜਣ ਦਾ ਉਤਸ਼ਾਹ ਦਿੰਦੇ ਆ